ਸਵੇਰੇ ਯੋਗ ਕਰਨ ਨਾਲ ਮੈਨੂੰ ਬਹੁਤ ਸਾਰੇ ਲਾਭ ਮਿਲੇ ਹਨ ਯੋਗਾ ਦਾ ਅਭਿਆਸ ਕਰਨਾ ਲਾਭਾਂ ਦੀ ਇੱਕ ਵਿਆਪਕ ਲੜੀ ਦੀ ਪੇਸ਼ਕਸ ਕਰਦਾ ਹੈ ਜੋ ਸਰੀਰਕ ਮਾਨਸਿਕ ਅਤੇ ਭਾਵਨਾਤਮਕ ਪਹਿਲੂਆਂ 'ਚ ਫੈਲਦਾ ਹੈ ਇਸ ਨੂੰ ਸਮੁੱਚੀ ਤੰਦਰੁਸਤੀ ਨੂੰ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਅਭਿਆਸ ਬਣਾਉਂਦਾ ਹੈ ਸਰੀਰਕ ਤੌਰ 'ਤੇ ਯੋਗਾ ਆਸਨ ਅਤੇ ਅੰਦੋਲਨਾਂ ਦੀ ਵਿਭਿੰਨ ਸ਼੍ਰੇਣੀ ਦੁਆਰਾ ਲਚਕਤਾ ਤਾਕਤ ਅਤੇ ਸੰਤੁਲਨ ਵਿੱਚ ਸੁਧਾਰ ਕਰਦਾ ਹੈ ਜੋ ਬਿਹਤਰ ਆਸਨ ਮਾਸਪੇਸ਼ੀਆਂ ਦੇ ਤਣਾਅ ਨੂੰ ਘਟਾਉਣ ਅਤੇ ਸੱਟ ਲੱਗਣ ਦੇ ਜੋਖਮ ਨੂੰ ਘਟਾਉਣ ਵਿੱਚ ਯੋਗਦਾਨ ਪਾ ਸਕਦਾ ਹੈ ਮਾਨਸਿਕ ਪੱਧਰ 'ਤੇ ਯੋਗਾ ਦਿਮਾਗੀ ਸਾਹ ਲੈਣ ਧਿਆਨ ਅਤੇ ਫੋਕਸਡ ਜਾਗਰੂਕਤਾ ਵਰਗੀਆਂ ਤਕਨੀਕਾਂ ਰਾਹੀਂ ਆਰਾਮ ਅਤੇ ਤਣਾਅ ਤੋਂ ਰਾਹਤ ਨੂੰ ਉਤਸ਼ਾਹ ਕਰਦਾ ਹੈ ਜੋ ਜਨਤਾ ਨੂੰ ਮਹੱਤਵਪੂਰਨ ਤੌਰ 'ਤੇ ਘਟਾ ਸਕਦਾ ਹੈ ਭਾਵਨਾਤਮਕ ਨਿਯਮਾਂ ਨੂੰ ਸੁਧਾਰ ਕਰਦਾ ਹੈ ਇਹ ਮਾਨਸਿਕਤਾ ਆਪਣੇ ਆਪ ਨਾਲ ਡੂੰਘੇ ਸੰਬੰਧ ਨੂੰ ਉਤਸ਼ਾਹ ਕਰਦੀ ਹੈ ਸਵੈਜਾਗਰੂਕਤਾ ਨੂੰ ਵਧਾਉਂਦੀ ਹੈ ਅੰਦਰੂਨੀ ਸ਼ਾਂਤੀ ਸਪੱਸ਼ਟਤਾ ਦੀ ਭਾਵਨਾ ਨੂੰ ਉਤਸ਼ਾਹ ਕਰਦੀ ਹੈ ਨਿਯਮਤ ਯੋਗਾ ਅਭਿਆਸ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਊਰਜਾ ਦੇ ਪੱਧਰ ਨੂੰ ਵਧਾਉਣ ਅਤੇ ਰੋਜ਼ਾਨਾ ਤਣਾਅ ਦੇ ਪ੍ਰਤੀ ਸਮੁੱਚੀ ਲਚਕੀਲਾਪਨ ਵਧਾਉਣ ਵਿੱਚ ਵੀ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਮਾਨਸਿਕ ਅਨੁਸ਼ਾਸਨ ਅਤੇ ਅਧਿਆਤਮਕ ਵਿਕਾਸ ਦੇ ਨਾਲ ਸਰੀਰਕ ਕਸਰਤ ਨੂੰ ਜੋੜ ਕੇ ਸਿਹਤ ਲਈ ਇੱਕ ਮਹੱਤਵਪੂਰਨ ਪਹੁੰਚ ਦਾ ਪਾਲਣ ਪੋਸ਼ਣ ਕਰਦਾ ਹੈ ਜਿਸ ਨਾਲ ਇੱਕ ਵਧੇਰੇ ਸੰਤੁਲਨ ਇੱਕ ਸੁਰਤਾ ਅਤੇ ਸੰਪੂਰਨ ਜੀਵਨ ਵੱਲ ਅਗਵਾਈ ਕਰਦਾ ਹੈ ਤੰਦਰੁਸਤੀ ਲਈ ਇਸ ਦੀ ਵਿਆਪਕ ਪਹੁੰਚ ਦੁਆਰਾ ਯੋਗਾ ਲੰਬੇ ਸਮੇਂ ਦੀ ਸਿਹਤ ਅਤੇ ਤੰਦਰੁਸਤ ਨੂੰ ਪ੍ਰਾਪਤ ਕਰਨ ਲਈ ਇੱਕ ਕੀਮਤੀ ਸਾਧਨ ਵਜੋਂ ਕੰਮ ਕਰ ਸਕਦਾ ਹੈ